ਸਾਡੇ ਪਿੰਡ ਵਿੱਚ ਸਿੰਚਾਈ ਦੀ ਸਹੂਲਤਾਂ ਹਨ ਕੁਝ ਦਹਾਕਿਆਂ ਪਹਿਲਾਂ ਸਿੰਚਾਈ ਖੂਹ ਦੇ ਪਾਣੀ ਨਾਲ ਕੀਤੀ ਜਾਂਦੀ ਸੀ ਪਰ ਅੱਜ ਕੱਲ੍ਹ ਦੇ ਦੌਰ ਵਿੱਚ ਸਿੰਚਾਈ ਦੇ ਸਾਧਨ ਟਿਊਬਵੈੱਲਾਂ ਹਨ ਟਿਊਬਵੈੱਲਾਂ ਰਾਹੀਂ ਖੇਤਾਂ ਦੇ ਵਿੱਚ ਵੱਟਾਂ ਦੇ ਰਾਹੀਂ ਵੱਟਾਂ ਅਤੇ ਖਾਲਾਂ ਦੀ ਮਦਦ ਨਾਲ ਖੇਤਾਂ ਵਿੱਚ ਪਾਣੀ ਪਹੁੰਚਾਇਆ ਜਾਂਦਾ ਹੈ ਅਤੇ ਅੱਜ ਕੱਲ੍ਹ ਦੇ ਸਮੇਂ ਵਿੱਚ ਪਾਈਪ ਲਾਇਨਾਂ ਹੀ ਵਿਛਾਈਆਂ ਜਾਂਦੀਆਂ ਹਨ ਜਿਸ ਨਾਲ ਕਿ ਪਾਈਪ ਦੇ ਢੱਕਣ ਖੋਲ੍ਹ ਕੇ ਉਨ੍ਹਾਂ ਵਿੱਚੋਂ ਸਿੱਧਾ ਸਿੰਚਾਈ ਕੀਤੀ ਜਾਂਦੀ ਹੈ ਪਾਈਪ ਵਾਲੀ ਸਿੰਚਾਈ ਜ਼ਿਆਦਾਤਰ ਉੱਥੇ ਹੁੰਦੀ ਹੈ ਜਿੱਥੇ ਟਿਊਬਵੈੱਲ ਖੇਤਾਂ ਦੂਰ ਤੱਕ ਸਿੰਚਾਈ ਕਰਵਾਉਣੀ ਹੋਵੇ ਜ਼ਿਆਦਾਤਰ ਸਿੰਚਾਈ ਵਾਲੀ ਜ਼ਮੀਨ ਵਿੱਚ ਝੋਨਾ ਲਗਾਇਆ ਜਾਂਦਾ ਹੈ ਜਿਸ ਨੂੰ ਕਿ ਸਿੰਚਾਈ ਦੀ ਸਭ ਤੋਂ ਵੱਧ ਲੋੜ ਪੈਂਦੀ ਹੈ